ਕਈ ਸਾਲ ਪਹਿਲਾਂ ਫੋਟੋ ਕਰਵਾਉਣ ਵਾਸਤੇ ਫੋਟੋਗ੍ਰਾਫਰ ਦੀ ਦੁਕਾਨ 'ਤੇ ਜਾਣਾ ਪੈਂਦਾ ਸੀ ਜਦੋਂ ਕਦੇ ਅਸੀਂ ਤਿਓਹਾਰਾਂ 'ਤੇ ਜਾਂ ਵਿਆਹ ਸ਼ਾਦੀ ਦੇ ਮੌਕੇ 'ਤੇ ਚੰਗੇ ਕੱਪੜੇ ਪਾ ਕੇ ਤਿਆਰ ਹੁੰਦੇ ਸੀ ਤਾਂ ਫੋਟੋ ਕਰਵਾਉਣ ਵਾਸਤੇ ਇੱਕ ਯਾਦਗਿਰੀ ਰੱਖਣ ਵਾਸਤੇ ਸਾਨੂੰ ਫੋਟੋਗ੍ਰਾਫਰ ਦੀ ਦੁਕਾਨ 'ਤੇ ਜਾਣਾ ਪੈਂਦਾ ਸੀ ਜਾਂ ਉਹਨੂੰ ਘਰ ਸੱਦਣਾ ਪੈਂਦਾ ਸੀ ਤਾਂ ਕਿ ਅਸੀਂ ਇੱਕ ਯਾਦ ਵਜੋਂ ਸਾਰੇ ਪਰਿਵਾਰ ਦੇ ਜੀਅ ਇਕੱਠੇ ਇੱਕ ਫੋਟੋ ਕਰਵਾ ਸਕੀਏ ਪੁਰਾਨੇ ਕੈਮਰਿਆਂ ਅਤੇ ਨਵੇਂ ਮੋਬਾਈਲ ਕੈਮਰਿਆਂ ਵਿੱਚ ਬਹੁਤ ਹੀ ਫਰਕ ਹੈ ਪੁਰਾਣੇ ਕੈਮਰਿਆਂ ਤੋਂ ਜਦੋਂ ਅਸੀਂ ਫੋਟੋਆਂ ਖਿੱਚਦੇ ਸੀ ਤਾਂ ਅਸੀਂ ਉਨ੍ਹਾਂ ਨੂੰ ਤੁਰੰਤ ਹੀ ਨਹੀਂ ਦੇਖ ਸਕਦੇ ਸੀ ਜਦੋਂ ਤੱਕ ਉਹ ਇੱਕ ਪੂਰੀ ਰੀਲ ਭਰ ਨਹੀਂ ਜਾਂਦੀ ਸੀ ਅਸੀਂ ਆਪਦੀਆਂ ਫੋਟੋਆਂ ਦੇਖ ਨਹੀਂ ਸਕਦੇ ਸੀ ਜਦੋਂ ਉਹ ਰੀਲ ਭਰ ਜਾਂਦੀ ਸੀ ਤਾਂ ਫਿਰ ਉਹਨੂੰ ਫੋਟੋਗ੍ਰਾਫੀ ਵਾਲੀ ਲੈਬ 'ਤੇ ਜਾ ਕੇ ਡਿਵੈਲਪ ਕਰਾਉਣ ਵਾਸਤੇ ਦੇਣਾ ਪੈਂਦਾ ਸੀ ਇੱਕ ਜਾਂ ਦੋ ਦਿਨ ਬਾਦ ਫੇਰ ਉਹ ਫੋਟੋਆਂ ਸਾਨੂੰ ਮਿਲਦੀਆਂ ਸੀ ਪਰ ਵਿਗਿਆਨ ਦੇ ਨਵੀਆਂ ਕਾਢਾਂ ਨਾਲ ਅੱਜ ਕੱਲ੍ਹ ਦੇ ਮੋਬਾਈਲ ਕੈਮਰਿਆਂ ਵਿੱਚ ਬਹੁਤ ਹੀ ਸੁਧਾਰ ਆ ਗਿਆ ਹੈ ਹੁਣ ਜਦੋਂ ਵੀ ਅਸੀਂ ਫੋਟੋ ਖਿੱਚਣੀ ਹੋਵੇ ਤਾਂ ਆਪਣੇ ਮੋਬਾਈਲ ਤੋਂ ਤੁਰੰਤ ਹੀ ਫੋਟੋ ਖਿੱਚ ਸਕਦੇ ਹਾਂ ਫਿਰ ਉਸਨੂੰ ਵੇਖ ਸਕਦੇ ਹਾਂ ਕਿ ਅਸੀਂ ਟੇਢੇ ਖੜ੍ਹੇ ਹਾਂ ਜਾਂ ਕਿਸੇ ਦੀਆਂ ਅੱਖਾਂ ਤਾਂ ਨਹੀਂ ਬੰਦ ਕਿਸੇ ਦਾ ਹੱਥ ਤਾਂ ਨਹੀਂ ਟੇਢਾ ਫਿਰ ਉਹਦੇ ਵਿੱਚ ਡਲੀਟ ਦੀ ਇੱਕ ਓਪਸ਼ਨ ਹੁੰਦੀ ਹੈ ਜਿਸ ਦੇ ਨਾਲ ਅਸੀਂ ਉਹ ਫੋਟੋ ਨੂੰ ਦੁਬਾਰਾ ਫੇਰ ਖਿੱਚ ਸਕਦੇ ਹਾਂ ਜੇ ਫੋਟੋ ਚੰਗੀ ਨਹੀਂ ਆਉਂਦੀ ਤਾਂ ਉਸਨੂੰ ਡਲੀਟ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਅੱਜ ਕੱਲ੍ਹ ਦੇ ਨਵੇਂ ਮੋਬਾਈਲ ਕੈਮਰਿਆਂ ਨਾਲ ਸਾਨੂੰ ਫੋਟੋਗ੍ਰਾਫੀ ਵਿੱਚ ਬਹੁਤ ਹੀ ਸੁਵਿਧਾ ਹੋਈ ਹੈ ਇਹ ਬਹੁਤ ਹੀ ਸੌਖਾ ਕੰਮ ਹੋ ਗਿਆ ਹੈ ਸਾਨੂੰ ਫੋਟੋਗ੍ਰਾਫਰ ਦੀ ਦੁਕਾਨ 'ਤੇ ਜਾ ਕੇ ਫੋਟੋ ਖਿਚਵਾਉਣ ਦੀ ਕੋਈ ਲੋੜ ਨਹੀਂ ਪੈਂਦੀ ਅਸੀਂ ਕਿਸੇ ਵੀ ਤਿਓਹਾਰ ਵਿਆਹ ਸ਼ਾਦੀ ਦੇ ਮੌਕੇ 'ਤੇ ਆਪਣੇ ਘਰ ਵਿੱਚ ਹੀ ਮੋਬਾਈਲ ਤੋਂ ਫੋਟੋਆਂ ਖਿੱਚ ਸਕਦੇ ਹਾਂ ਅਤੇ ਤੁਰੰਤ ਹੀ ਉਨ੍ਹਾਂ ਨੂੰ ਦੇਖ ਸਕਦੇ ਹਾਂ ਉਹ ਫੋਟੋਆਂ ਸਾਰੀਆਂ ਫੋਟੋਆਂ ਸਾਡੇ ਮੋਬਾਈਲ ਦੇ ਇੱਕ ਇੱਕ ਐਪ ਵਿੱਚ ਸਟੋਰ ਹੋ ਜਾਂਦੀਆਂ ਹਨ ਜਿਸ ਨਾਲ ਅਸੀਂ ਉਨ੍ਹਾਂ ਨੂੰ ਥੋੜ੍ਹੇ ਚਿਰ ਬਾਅਦ ਦੇਖ ਸਕਦੇ ਹਾਂ